ਭੰਗੜਾ ਸਾਡੇ ਪੰਜਾਬ ਦਾ ਮੁੱਖ ਡਾਂਸ ਹੈ ਇਸ ਨੂੰ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਕਰਦੇ ਹਨ ਇਸ ਨੂੰ ਕਰਨ ਲਈ ਪੰਜਾਬ ਦੇ ਵਿੱਚ ਬਹੁਤ ਅਖਾੜੇ ਲੱਗਦੇ ਹਨ ਅਤੇ ਉਸ ਲਈ ਬਹੁਤ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਪਰ ਭੰਗੜਾ ਔਰੋਬਿਕਸ ਅੱਜ ਦੇ ਨਵੇਂ ਜ਼ਮਾਨੇ ਦੀ ਚੀਜ਼ ਹੈ ਪਰ ਇਸ ਲਈ ਬਹੁਤ ਜ਼ਿਆਦਾ ਕੋਈ ਅੋਡੀਸ਼ਨ ਵਗੈਰਾ ਨਹੀਂ ਕੀਤੇ ਜਾ ਰਹੇ ਪਰ ਇਸ ਨੂੰ ਕਰਨ ਦੇ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਹ ਚੀਜ਼ ਆਪਣੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ ਜਿਸ ਨੂੰ ਕਰਨ ਦੇ ਲਈ ਸਾਡੇ ਸਰੀਰ ਦਾ ਵਿਕਾਸ ਹੋਵੇਗਾ ਅਤੇ ਕਈ ਸਾਡੀਆਂ ਬਿਮਾਰੀਆਂ ਦੂਰ ਹੋਣਗੀਆਂ ਇਸ ਦੇ ਨਾਲ ਸਾਡਾ ਉਹ ਬਹੁਤ ਵਧੀਆ ਹੋ ਜਾਵੇਗੀ ਅਤੇ ਅਸੀਂ ਇੱਕ ਸਿਹਤਮੰਦ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੀਅ ਸਕਾਂਗੇ ਅਤੇ ਇਸ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਧੰਨਵਾਦ